ਹੈਲੋ ਹਾਂਜੀ ਭਾਅ ਜੀ ਵੀਰੇ ਤੁਹਾਡੀ ਕਾਰ ਓਲਾ ਕੈਬ ਤੋਂ ਮੈਂ ਨਾ ਸੋਫਟਵੇਅਰ ਤੋਂ ਮੇਰੇ ਖਿਆਲ ਦਸ ਪੰਦਰ੍ਹਾਂ ਮਿੰਟ ਤਾਂ ਹੋ ਗਏ ਬੁੱਕ ਕੀਤੀ ਨੂੰ ਅਤੇ ਮੈਂ ਜਦ ਦੀ ਤੁਹਾਡੀ ਲੋਕੇਸ਼ਨ ਦੇਖੀ ਜਾਂਦਾ ਤੁਸੀਂ ਇੱਕੋ ਜਗ੍ਹਾ ਖੜ੍ਹੇ ਹਾਂ ਹਾਂਜੀ ਮੈਂ ਹੁਣ ਇਸ ਟਾਈਮ ਜਿਹੜਾ ਆਪਣਾ ਫੋਰਟੀਸ ਹੋਸਪੀਟਲ ਹੈ ਉਹਦੇ ਮੂਹਰੇ ਖੜ੍ਹਾ ਹਾਂ ਕਿੰਨਾਂ ਟਾਈਮ ਹੋ ਗਿਆ ਤੁਹਾਡੀ ਲੋਕੇਸ਼ਨ ਦੇਖਦਿਆਂ ਨੂੰ ਸਾਰਾ ਕੁਛ ਤੁਸੀਂ ਇੱਕੋ ਜਗ੍ਹਾ ਹੀ ਘੁੰਮੀ ਜਾਂਦੇ ਹਾਂ ਗੋਲ ਗੋਲ ਠੀਕ ਹੈ ਅਤੇ ਹੁਣ ਮੈਂ ਕਿੰਨਾਂ ਕੁ ਟਾਈਮ ਇੱਥੇ ਖੜ੍ਹਾਂ ਜਾਂ ਤਾਂ ਆ ਜੋ ਨਹੀਂ ਤਾਂ ਮੇਰਾ ਵੀਰ ਮੈਂ ਤੁਹਾਡਾ ਆਹ ਕੈਂਸਲ ਕਰ ਦੇਣਾ ਅਤੇ ਤੁਹਾਡੀ ਜਿਹੜੀ ਵਿੱਚ ਇਹ ਹੈਗੀ ਆ ਨਾ ਕੰਪਨੀ ਇਹਦੇ ਵਿੱਚ ਤੁਹਾਡੇ ਜਿਹੜਾ ਰਿਵਿਊ ਆ ਉਹ ਗਲਤ ਪਾ ਦੇਣੇ ਆ ਫਿਰ ਤੁਸੀਂ ਮੈਨੂੰ ਨਾ ਕਿਹੋ ਠੀਕ ਹੈ ਜੀ ਹਾਂ ਮੇਰਾ ਵੀਰ ਛੇਤੀ ਛੇਤੀ ਆਜਾ ਨਹੀਂ ਤਾਂ ਬਾਅਦ ਵਿੱਚ ਨਾ ਕਿਹੋ ਵੀ ਤੇਰੇ ਰਿਵਿਊ ਗਲਤ ਪਾ ਤੇ ਠੀਕ ਹੈ ਆਜਾ